ਹੈਲੋ ਕਿਆ ਹਾਲ ਹੈ ਵਧੀਆ ਜਿਵੇਂ ਤੁਹਾਨੂੰ ਪਤਾ ਕਿ ਮੈਂ ਹੁਣੇ ਜੰਮੂ ਵਿੱਚ ਸ਼ਿਫਟ ਹੋਈ ਹਾਂ ਪਠਾਨਕੋਟ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇੱਧਰ ਕੀ ਕੀ ਮਤਲਵ ਮਸ਼ਹੂਰ ਹੈ ਖਾਣ ਪੀਣ ਦੀਆਂ ਬਾਕੀ ਸਭ 'ਚ

ਹਾਂਜੀ ਹਾਂਜੀ ਨਾਨ ਤਾਂ ਮੈਨੂੰ ਸਾਨੂੰ ਬਹੁਤ ਪਸੰਦ ਹੈ ਅਸੀਂ ਹਰ ਐਤਵਾਰ ਖਾਂਦੇ ਹੁੰਦੇ ਇੱਧਰ ਕੋਈ ਮਸ਼ਹੂਰ ਜਗ੍ਹਾ ਅੱਛਾ ਅਤੇ ਕਈ ਵਾਰ ਰੋਟੀ ਬਣਾਉਣ ਦਾ ਮੰਨ ਨਾ ਕਰੇ ਤਾਂ ਘਰ ਦੀ ਰੋਟੀ ਕਿੱਥੋਂ ਮਿਲੇਗੀ ਮੈਨੇ ਮੈਂ ਕਿਹਾ ਜੇ ਅਗਰ ਕਈ ਵਾਰ ਰੋਟੀ ਖਾਣ ਦਾ ਦਿਲ ਨਾ ਕਰੇ ਘਰ ਬਣਾਉਣ ਦਾ ਦਿਲ ਨਾ ਕਰੇ ਤਾਂ ਤੁਸੀਂ ਬਾਹਰੋਂ ਦੀ ਰੋਟੀ ਕਿੱਥੋਂ ਮਿਲੇਗੀ ਸਹੀ ਅੱਛਾ ਹੋਮ ਡਿਲੀਵਰੀ ਵੀ ਹੋ ਜਾਏਗੀ ਇੱਥੇ ਚਲੋ ਠੀਕ ਹੈ ਫਿਰ